ਮੈਂ ਆਲੂ ਦੀ ਸਬਜ਼ੀ ਬਣਾਈ ਸੀ ਜੋ ਕਿ ਖਾਣ ਵਿੱਚ ਬਿਲਕੁਲ ਵੀ ਸਵਾਦ ਨਹੀਂ ਲੱਗਿਆ ਮੈਨੂੰ ਪਤਾ ਨਹੀਂ ਉਹਦੇ ਵਿੱਚ ਕੀ ਕਮੀ ਰਹਿ ਗਈ ਸੀ ਪਰ ਖਾਣ ਵਿੱਚ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਫਿਰ ਮੈਂ ਆਲੂ ਦੀ ਸਬਜ਼ੀ ਬਣਾਉਣ ਲੱਗੀ ਪਰ ਉਹਦੇ ਵਿੱਚ ਮੈਂ ਮਟਰ ਪਾ ਕੇ ਉਹਨੂੰ ਉਸ ਵਰਗਾ ਹੀ ਸਬਜ਼ੀ ਬਣਾਉਣਾ ਚਾਹੁੰਦੀ ਸੀ ਕਿ ਜੋ ਖਾਣ ਵਿੱਚ ਮੈਨੂੰ ਜ਼ਿਆਦਾ ਸਵਾਦ ਲੱਗੇ ਆਲੂ ਨੂੰ ਸਭ ਤੋਂ ਪਹਿਲਾਂ ਮੈਂ ਆਲੂ ਨੂੰ ਛਿੱਲਿਆ ਅਤੇ ਮਟਰ ਨੂੰ ਛਿੱਲਿਆ ਉਹਦੇ ਬਾਅਦ ਉਹਨਾਂ ਨੂੰ ਧੋਕੇ ਸਾਈਡ ਕਰਤਾ ਅਤੇ ਉਹਦੇ ਬਾਅਦ ਪਿਆਜ਼ ਨੂੰ ਛਿੱਲਿਆ ਲੱਸਣ ਨੂੰ ਛਿੱਲਿਆ ਉਹਨੂੰ ਨੂੰ ਮਿਕਸਚਰ 'ਚ ਡਾਲ ਕੇ ਉਹਨਾਂ ਦੇ ਮਸਾਲਿਆਂ ਪਾ ਕੇ ਗਰਮ ਮਸਾਲਿਆਂ ਜ਼ੀਰਾ ਕਾਲੀ ਮਿਰਚ ਵਿੱਚ ਪਾ ਕੇ ਉਹਨਾਂ ਨੂੰ ਗ੍ਰਾਇੰਡ ਕਰ ਲਿਆ ਅਤੇ ਉਹਨੂੰ ਪੈਨ ਵਿੱਚ ਔਇਲ ਡਾਲ ਕੇ ਫਿਰ ਉਹਨਾਂ ਮਸਾਲਿਆਂ ਨੂੰ ਪੈਨ ਵਿੱਚ ਪਾ ਦਿੱਤਾ ਅਤੇ ਉਹਨਾਂ ਨੂੰ ਭੁੰਨਣ ਲਈ ਛੱਡਤਾ ਪੰਜ ਦਸ ਮਿਨਟ ਲਈ ਫਿਰ ਪੰਜ ਦਸ ਮਿਨਟ ਬਾਅਦ ਉਹਨਾਂ ਨੂੰ ਮੈਂ ਅੱਛੀ ਤਰ੍ਹਾਂ ਚਲਾਇਆ ਅਤੇ ਉਹਨਾਂ ਵਿੱਚ ਸਬਜ਼ੀਆਂ ਨੂੰ ਐਡ ਕਰਤਾ ਫਿਰ ਉਹਨਾਂ ਨੂੰ ਪੰਜ ਦਸ ਮਿਨਟ ਲਈ ਛੱਡਤਾ ਉਹਨਾਂ ਤੋਂ ਬਾਅਦ ਉਹਨਾਂ ਨੂੰ ਚਲਾ ਕੇ ਅੱਛੀ ਤਰ੍ਹਾਂ ਉਹਦੇ ਵਿੱਚ ਸਾਰੇ ਮਸਾਲੇ ਪਾ ਕੇ ਅਤੇ ਉਹਨਾਂ ਨੂੰ ਆਧੇ ਘੰਟੇ ਲਈ ਪੱਕਣ ਨੂੰ ਛੱਡਤਾ ਉਹਦੇ ਬਾਅਦ ਆਧੇ ਘੰਟੇ ਬਾਅਦ ਮੈਂ ਜਦ ਦੇਖਿਆ ਤੋਂ ਮੇਰੀ ਸਬਜ਼ੀ ਤਿਆਰ ਹੋ ਗਈ ਸੀ ਅਤੇ ਉਹਨਾਂ ਨੂੰ ਮੈਂ ਜਬ ਮੈਂ ਖਾਇਆ ਤਾਂ ਬਹੁਤ ਹੀ ਜ਼ਿਆਦਾ ਸਵਾਦ ਬਣੀ ਸੀ